ਸੁੰਦਰ ਅਤੇ ਵਿਲੱਖਣ ਚੜ੍ਹਨ ਵਾਲ਼ੀਆਂ ਉੱਚੀਆਂ ਬਹੁਤ ਹੀ ਥਾਵਾਂ ਹਨ ਜਿਹਨਾਂ ਵਿੱਚੋਂ ਇੱਕ ਅਮਰਨਾਥ ਹੈ ਜਿੱਥੇ ਕਿ ਮੈਂ ਖੁਦ ਗਿਆ ਵੀ ਹੋਇਆ ਉੱਥੋਂ ਦੀ ਚੜ੍ਹਾਈ ਬਹੁਤ ਹੀ ਜ਼ਿਆਦਾ ਕਹਿ ਲਓ ਕਿ ਬਹੁਤ ਔਖੀ ਹੈ ਅਤੇ ਮੈਨੂੰ ਚੜ੍ਹਨ 'ਚ ਬਹੁਤ ਦਿੱਕਤ ਆਈ ਪਰੰਤੂ ਕਿਵੇਂ ਨਾ ਕਿਵੇਂ ਕਰਕੇ ਮੈਂ ਉੱਥੇ ਚੜ੍ਹ ਗਿਆ